ਪ ਅ ਪੁਰਾਣੇ ਸਮੇਂ ਨਾਲੋਂ ਹੁਣ ਦੇ ਸਮੇਂ ਵਿੱਚ ਬਹੁਤ ਤਬਦੀਲੀਆਂ ਆਈਆਂ ਹਨ ਹੁਣ ਦੇ ਸਮੇਂ ਵਿੱਚ ਬਹੁਤ ਸਾਰੀਆਂ ਟੈਕਨੋਲਜੀਆਂ ਆ ਗਈਆਂ ਹਨ ਪਹਿਲਾਂ ਇਹ ਟੈਕਨੋਲਜੀ ਨਹੀਂ ਹੁੰਦੀ ਸੀ ਪਹਿਲਾਂ ਲੋਕ ਲੋਕਾਂ ਦੇ ਘਰਾਂ ਵਿੱਚ ਲੈਂਡਲਾਈਨ ਵਰਤੇ ਜਾਂਦੇ ਸੀ ਜੋ ਕਿ ਇੱਕ ਤਾਰ ਨਾਲ਼ ਜੁੜੇ ਹੁੰਦੇ ਸਨ ਅਤੇ ਉਸੇ ਜਗ੍ਹਾ 'ਤੇ ਬੈਠ ਕੇ ਹੀ ਕਿਸੇ ਨਾਲ਼ ਗੱਲ ਕੀਤੀ ਜਾਂਦੀ ਸੀ ਪਰ ਹੁਣ ਦੇ ਜ਼ਮਾਨੇ ਵਿੱਚ ਮੋਬਾਇਲ ਫੋਨ ਆ ਗਏ ਹਨ ਕਿਤੇ ਵੀ ਜਾ ਕੇ ਅਸੀਂ ਉਸ ਉਸ ਨਾਲ਼ ਗੱਲ ਕਰ ਸਕਦੇ ਹਾਂ ਪਹਿਲਾਂ ਦੇ ਜ਼ਮਾਨੇ ਵਿੱਚ ਲੋਕ ਹੇਠਾਂ ਬੈਠ ਕੇ ਹੱਥਾਂ ਨਾਲ਼ ਰੋਟੀ ਖਾਂਦੇ ਸੀ ਪਰ ਹੁਣ ਦੇ ਜ਼ਮਾਨੇ ਵਿੱਚ ਲੋਕ ਟੇ ਡੈਨਿੰਗ ਟੇਬਲ ਪਰ ਬੈਠ ਕੇ ਚਮਚਿਆਂ ਨਾਲ਼ ਰੋਟੀ ਖਾਂਦੇ ਹਨ ਪਹਿਲਾਂ ਵਾਲੇ ਜ਼ਮਾਨੇ ਨਾਲੋਂ ਹੁਣ ਦੇ ਜ਼ਮਾਨੇ ਵਿੱਚ ਬਹੁਤ ਫ਼ਰਕ ਆਇਆ ਹੈ ਪਹਿਲਾਂ ਲੋਕ ਪੈਦਲ ਕਿਤੇ ਜਾਂਦੇ ਸੀ ਪਰ ਹੁਣ ਟੈਕਨੋਲਜੀ ਦੇ ਕਾਰਨ ਬਹੁਤ ਸਾਰੇ ਸਾਧਨ ਵਿਕਸਿਤ ਹੋਏ ਹਨ ਜਿਸ ਕਾਰਨ ਲੋਕ ਹੁਣ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕਰਦੇ ਹਨ ਅਤੇ ਆਵਾਜਾਈ ਦੇ ਸਾਧਨਾਂ ਰਾਹੀਂ ਹੀ ਕਿਤੇ ਜਾਂਦੇ ਹਨ ਅੱਜ ਕੱਲ੍ਹ ਕੋਈ ਪੈਦਲ ਨਹੀਂ ਜਾਂਦਾ ਇਸ ਟੈਕਨੋਲੋਜੀ ਨੇ ਸਾਡੇ ਜੀਵਨ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਲਿਆਂਦੀਆਂ ਹਨ